ਜਾਨਵਰਾਂ ਦੀ ਦੇਖਭਾਲ ਜਾਨਵਰਾਂ ਨੂੰ ਸਹੀ ਟਾਈਮ ਦੇ ਉੱਤੇ ਪੱਠੇ ਪਾਉਣਾ ਪਾਣੀ ਪਿਲਾਉਣਾ ਉਹਨਾਂ ਨੂੰ ਨਵਾਉਣਾ ਡੰਗ ਪਸ਼ੂਆਂ ਨੂੰ ਔਰ ਉਹਨਾਂ ਦਾ ਆਲਾ ਦੁਆਲਾ ਅੱਛੀ ਤਰੀਕੇ ਨਾਲ ਸਾਫ਼ ਕਰਨਾ ਪਸ਼ੂਆਂ ਦਾ ਟੈਮ ਟੈਮ ਨਾਲ ਉਹਨਾਂ ਨੂੰ ਪੱਠੇ ਪਾਉਣਾ ਪਾਣੀ ਪਿਲਾਉਣਾ ਇਸ ਤਰੀਕੇ ਨਾਲ ਪਸ਼ੂਆਂ ਦੀ ਦੇਖਭਾਲ ਕੀਤੀ ਜਾਂਦੀ ਸੀ ਧੰਨਵਾਦ